ਪੰਜਾਬ ਵਿੱਚ ਰਾਜ ਸਰਕਾਰ ਭਾਈਚਾਰੇ ਨੂੰ ਦਰਪੇਸ ਸਮੱਸਿਆ ਨੂੰ ਬਹੁਤ ਤਰ੍ਹਾਂ ਹੱਲ ਕੀਤਾ ਹੈ ਉਹਨਾਂ ਨੇ ਇਸ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਜਿਵੇਂ ਕਾਸਟਿਜ਼ਮ ਨੂੰ ਲੈ ਕੇ ਉਹਨਾਂ ਨੇ ਬਹੁਤ ਕੁਛ ਹੁਣ ਠੀਕ ਕਰ ਦਿੱਤਾ ਹੈ ਪਹਿਲਾਂ ਕਾਸਟ ਨੂੰ ਲੈ ਕੇ ਬਹੁਤ ਸਾਰੇ ਦੰਗੇ ਫਸਾਦ ਹੁੰਦਾ ਸੀਗਾ ਜੋ ਕਿ ਹੁਣ ਇਹ ਚੀਜ਼ਾਂ ਖਤਮ ਹੋ ਗਈਆਂ ਹਨ ਸਭ ਧਰਮ ਸਭ ਕੁਲਾਂ ਇੱਕੋ ਹੀ ਕਿਹਾ ਜਾਂਦਾ ਹੈ ਕਾਸਟ ਨੂੰ ਦੇਖ ਰੇਖ ਵਿੱਚ ਰੱਖ ਕੇ ਹੁਣ ਕੋਈ ਲੜਾਈ ਝਗੜਾ ਨਹੀਂ ਕੀਤਾ ਜਾਂਦਾ ਹੈ ਉਸ ਦੇ ਨਾਲ ਨਾਲ ਹੁਣ ਪ੍ਰੋਪਰਟੀ ਦੇ ਨਾਲ ਨਾਲ ਹੁਣ ਸਾਰੇ ਰਾਈਟਸ ਵੀ ਮਿਲਣੇ ਸ਼ੁਰੂ ਹੋ ਗਏ ਹਨ ਜਿਸ ਵਿੱਚ ਭਰਾ ਭੈਣ ਨੂੰ ਆਪਸ ਵਿੱਚ ਇੱਕੋ ਜਿਹਾ ਹੀ ਹਿੱਸਾ ਮਿਲਦਾ ਹੈ ਕੋਈ ਲੜਾਈ ਝਗੜਾ ਨਹੀਂ ਹੁੰਦਾ ਕਾਸਟ ਨੂੰ ਲੈ ਕੇ ਸਾਡੇ ਬੱਚਿਆਂ ਨੂੰ ਪਹਿਲਾਂ ਤਾਂ ਇਹ ਚੀਜ਼ਾਂ ਬਾਰੇ ਕੁਛ ਪਤਾ ਨਹੀਂ ਹੁੰਦਾ ਸੀ ਅੱਜ ਕੱਲ੍ਹ ਵੀ ਇਹ ਚੀਜ਼ਾਂ ਬਾਰੇ ਕੁਝ ਨਹੀਂ ਪਤਾ ਸੀ ਪਰ ਸਾਡੇ ਬੱਚਿਆਂ ਨੂੰ ਹੁਣ ਇਹ ਚੀਜ਼ਾਂ ਦੀ ਪੂਰੀ ਨੌਲੇਜ ਵੀ ਦਿੱਤੀ ਜਾਂਦੀ ਹੈ ਕਿ ਪਹਿਲਾਂ ਕਾਸਟ ਨੂੰ ਲੈ ਕੇ ਲੜਾਈ ਝਗੜੇ ਦੰਗੇ ਬਹੁਤ ਕੁਝ ਹੁੰਦਾ ਸੀ ਭਾਰਤ ਸਰਕਾਰ ਨੇ ਹੁਣ ਇਹ ਚੀਜ਼ਾਂ ਸਾਰੀਆਂ ਖਤਮ ਕਰ ਦਿੱਤੀਆਂ ਹਨ ਕਾਸਟਿਜ਼ਮ ਦੇ ਨਾਲ ਨਾਲ ਸ਼ਾਂਤੀ ਦੇ ਨਾਲ ਨਾਲ ਪ੍ਰੋਪਰਟੀ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਹਰ ਤਰਫ ਬਹੁਤ ਬਹੁਤ ਆਪਣਾ ਚੰਗੀ ਤਰ੍ਹਾਂ ਇਹ ਸਮੱਸਿਆਵਾਂ ਖਤਮ ਕਰ ਦਿੱਤੀਆਂ ਹਨ ਜਿਸ ਨੂੰ ਦੇਖ ਰੇਖ ਦੇ ਵਿੱਚ ਰੱਖ ਕੇ ਪੰਜਾਬ ਸਰਕਾਰ ਨੇ ਇਸ ਨੂੰ ਬਹੁਤ ਵਧੀਆ ਹੀ ਕਰ ਦਿੱਤਾ ਹੈ ਧੰਨਵਾਦ